ਪੰਜਾਬ ਵਿੱਚ ਬਹੁਤ ਸਾਰੇ ਖੇਡਾਂ ਦਾ ਟੂਰਨਾਮੈਂਟ ਹੁੰਦਾ ਹੈ ਜਿਵੇਂ ਰੱਸਾਕਸ਼ੀ ਕਬੱਡੀ ਕੁਸ਼ਤੀ ਦੰਗਲ ਆਦਿ ਇਹਨਾਂ ਵਿੱਚੋਂ ਬਹੁਤ ਸਾਰੇ ਖੇਡ ਐਦਾਂ ਵੀ ਹੈ ਜਿਸ ਨੂੰ ਪੰਜਾਬ ਵਿੱਚ ਬਹੁਤ ਹੀ ਜ਼ਿਆਦਾ ਮੰਨਿਆ ਜਾਂਦਾ ਹੈ ਅਤੇ ਖੇ ਖੇਡਣ ਲਈ ਬਹੁਤ ਜ਼ਿਆਦਾ ਉਸਦੇ ਲੋਕਾਂ ਵਿੱਚ ਉਤਸ਼ਾਹ ਹੁੰਦਾ ਹੈ ਜਿਵੇਂ ਕਬੱਡੀ ਖੇਡਣ ਲਈ ਲੋਕ ਬਹੁਤ ਪਿੰਡਾਂ ਵਿੱਚ ਇਕੱਠੇ ਹੁੰਦੇ ਹਨ ਅਤੇ ਡੇਲੀ ਸ਼ਾਮ ਨੂੰ ਖੇਡਦੇ ਹਨ ਅਤੇ ਇਸ ਖੇਡ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਖੇਡਿਆ ਜਾਂਦਾ ਹੈ ਅੱਜ ਦੇ ਅੱਜ ਕੱਲ੍ਹ ਦੇਖਿਆ ਜਾਵੇ ਤਾਂ ਕਬੱਡੀ ਇੱਕ ਅਜਿਹਾ ਖੇਡ ਬਣ ਚੁੱਕਾ ਹੈ ਜੋ ਕਿ ਵਿਦੇਸ਼ਾਂ ਵਿੱਚ ਵੀ ਬੜੇ ਚਾਅ ਨਾਲ ਖੇਡਿਆ ਜਾਂਦਾ ਹੈ ਅਤੇ ਪੰਜਾਬ ਦੇ ਲੋਕਾਂ ਨੇ ਇਸ ਨੂੰ ਬਹੁਤ ਉੱਤੇ ਸ ਉੱਚੇ ਸਤਰ 'ਤੇ ਲੈ ਕੇ ਜਗ ਜਾ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਕੁਸ਼ਤੀ ਭਾਵੇਂ ਕ੍ਰਿਕਟ ਵੀ ਅਜਿਹੇ ਖੇਡ ਹਨ ਜੋ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਤਰ 'ਤੇ ਵੀ ਖੇਡੇ ਜਾ ਸਕਦੇ ਹਨ ਕਿਉੰਕਿ ਪੂਰੇ ਭਾਰਤ ਵਿੱਚ ਜਾਂ ਪੰਜਾਬ ਵਿੱਚ ਦੇਖਿਆ ਜਾਵੇ ਤਾਂ ਕ੍ਰਿਕਟ ਨੂੰ ਬਹੁਤ ਜ਼ਿਆਦਾ ਲੋਕ ਦੇਖਣ ਵਾਲੇ ਹਨ ਅਤੇ ਇਸ ਨੂੰ ਪਸੰਦ ਵੀ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ